ਹਾਂਜੀ ਡਰਾਇਵਰ ਰਣਜੀਤ ਸਿੰਘ ਜੀ ਆਪਾਂ ਅੰਬਾਲੇ ਪਹੁੰਚ ਚੁੱਕੇ ਹਾਂ ਅਤੇ ਤੁਹਾਡੀ ਓਲਾ ਦੀ ਗੱਡੀ ਕਿੰਨੇ ਕਿਲੋਮੀਟਰ ਚੱਲ ਚੁੱਕੀ ਹੈ ਮੈਂ ਤੁਹਾਨੂੰ ਤੁਹਾਡੇ ਕਿਰਾਏ ਦਾ ਭੁਗਤਾਨ ਕਰ ਦੇਵਾਂ ਤੁਹਾਡਾ ਕਿਰਾਇਆ ਬਹੁਤ ਜ਼ਿਆਦਾ ਬਣ ਚੁੱਕਾ ਹੈ ਅਤੇ ਮੇਰੇ ਕੋਲ ਕੈਸ਼ ਘੱਟ ਹੈਗਾ ਹੈ ਡਰਾਇਵਰ ਜੀ ਤੁਸੀਂ ਕੋਈ ਗੂਗਲ ਪੇਅ ਜਾਂ ਫ਼ੋਨ ਪੇਅ ਚਲਾਉਂਦੇ ਹੋ ਨਹੀਂ ਚਲਾਉਂਦੇ ਜੇਕਰ ਤੁਸੀਂ ਨਹੀਂ ਚਲਾਉਂਦੇ ਤਾਂ ਤੁਹਾਡਾ ਕੰਪਨੀ ਦਾ ਕੋਈ ਗੂਗਲ ਪੇਅ ਨੰਬਰ ਹੋਏਗਾ ਮੈਨੂੰ ਦੱਸ ਦਿਉ ਮੈਂ ਉਹਦੇ ਵਿੱਚ ਟਰਾਂਸਫਰ ਕਰ ਦੇਨਾ ਤੁਹਾਡੇ ਬਣਦਾ ਕਿਰਾਇਆ ਜੇਕਰ ਤੁਸੀਂ ਕੈਸ਼ ਲੈਣਾ ਚਾਹੁੰਦੇ ਹੋ ਤਾਂ ਮੈਂ ਫਿਰ ਕਿਸੇ ਲਾਗਲੇ ਏ ਟੀ ਐੱਮ ਤੋਂ ਕੈਸ਼ ਕਢਾ ਲਿਆਉਂਦਾ ਹਾਂ ਅਤੇ ਤੁਹਾਨੂੰ ਮੈਂ ਕੈਸ਼ ਆਣ ਕੇ ਭੁਗਤਾਨ ਕਰ ਦੇਨਾ ਬਾਕੀ ਤੁਸੀਂ ਹੁਣ ਜ਼ਮਾਨਾ ਥੋੜ੍ਹਾ ਡਿਜੀਟਲ ਹੋ ਚੁੱਕਾ ਹੈ ਅਤੇ ਤੁਸੀਂ ਆਪਣਾ ਗੂਗਲ ਪੇਅ ਫ਼ੋਨਪੇਅ ਆਪਣੇ ਮੋਬਾਈਲ ਨੰਬਰ 'ਤੇ ਜ਼ਰੂਰ ਚਲਾਓ ਤਾਂ ਜੋ ਤੁਹਾਨੂੰ ਵੀ ਪੈਸੇ ਲੈਣ ਦੀ ਦਿੱਕਤ ਨਾ ਆਵੇ ਅਤੇ ਸਵਾਰੀ ਵੀ ਜਿਹੜੀ ਹੈ ਉਹ ਉਸਦਾ ਵੀ ਸਮਾਂ ਖ਼ਰਾਬ ਨਾ ਹੋਵੇ ਬਹੁਤ ਬਹੁਤ ਤੁਹਾਡਾ ਧੰਨਵਾਦ ਮੈਂ ਤੁਹਾਨੂੰ ਗੂਗਲ ਪੇਅ ਤੁਹਾਡੇ ਕੰਪਨੀ ਦੇ ਨੰਬਰ 'ਤੇ ਕਰ ਦਿੰਦਾ ਹਾਂ